ਸਰ ਸਤਿ ਸ਼੍ਰੀ ਅਕਾਲ ਜੀ ਸੋ ਅਸੀਂ ਗੈਰੀਅਨ ਜੋ ਗੋਲੀਆਂ ਦਵਾਈ ਹੈ ਸੋ ਉਹ ਮੰਗਵਾਈ ਸੀ ਉਹ ਸਾਡੇ ਕੋਲ ਅਜੇ ਤੱਕ ਪਹੁੰਚੀ ਨਹੀਂ ਹੈ ਸੋ ਉਹ ਕਿੰਨੇ ਕਿਤਨੇ ਕੁ ਸਮੇਂ ਤੱਕ ਸਾਡੇ ਕੋਲ ਪਹੁੰਚ ਜਾਵੇਗੀ ਸੋ ਇਸ ਦੇ ਨਾਲ ਜੋ ਸਾਨੂੰ ਜ਼ਰੂਰ ਇਸ ਦੀ ਬਹੁਤ ਜ਼ਰੂਰਤ ਹੈ ਸੋ ਅਸੀਂ ਪੂਰੇ ਲੋੜਵੰਦ ਹਾਂ ਸਾਨੂੰ ਇਹ ਦਵਾਈ ਛੇਤੀ ਤੋਂ ਜਲਦੀ ਤੋਂ ਜਲਦੀ ਚਾਹੀਦੀ ਹੈ ਜੀ ਆਪ ਜੀ ਦਾ ਧੰਨਵਾਦ ਜੀ